ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਦਸ਼ਮੇਸ਼ ਬੁੱਕ ਡਿਪੂ ਤੋਂ ਬੋਲਦੇ ਹੋ ਹਾਂ ਮੈਮ ਅਸੀਂ ਨਾ ਕੁਛ ਬੁੱਕਸ ਲੈਣੀਆਂ ਸੀਗੀਆਂ ਕੀ ਤੁਹਾਡੇ ਕੋਲ ਮਿਲ ਜਾਂਦੀਆਂ ਨੇ ਕਿਹੜੀਆਂ ਕਿਹੜੀਆਂ ਬੁੱਕਸ ਨੇ ਤੁਹਾਡੇ ਕੋਲ ਬੁੱਕ ਡਿਪੂ 'ਤੇ ਹਾਂਜੀ ਓਕੇ ਮੈਮ ਅਤੇ ਮੈਮ ਨੈੱਟ ਦੀਆਂ ਮਿਲ ਜਾਣਗੀਆਂ ਮੈਮ ਐਕਚੁਲੀ ਨਾ ਅਸੀਂ ਮਤਲਬ ਕਿ ਪੰਜਾਬੀ ਦੇ ਨੈੱਟ ਦੀ ਬੁੱਕਸ ਲੈਣੀਆਂ ਸੀ ਕੀ ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਹੋ ਕਿ ਅਸੀਂ ਕਿਹੜੀਆਂ ਕਿਹੜੀਆਂ ਬੁੱਕਸ ਜੋ ਹੈ ਮਤਲਬ ਲੈ ਸਕਦੇ ਹਾਂ ਓਕੇ ਜੀ ਓਕੇ ਜੀ ਓਕੇ ਮੈਮ ਅਤੇ ਮੈਮ ਤੁਸੀਂ ਇਹ ਬੁੱਕ ਮਤਲਬ ਔਨਲਾਈਨ ਮਤਲਬ ਜੇ ਅਸੀਂ ਔਡਰ ਕਰ ਦੇਈਏ ਤਾਂ ਤੁਸੀਂ ਉਹਦੇ ਥਰੂ ਮਤਲਬ ਸਾਡੇ ਪੋਸਟ ਕਰ ਸਕਦੇ ਹੋ ਸਾਨੂੰ ਬੁੱਕਸ ਪਹੁੰਚਾ ਸਕਦੇ ਹੋ

ਓਕੇ ਮੈਮ ਮੈਮ ਇੱਕ ਇਹ ਪ੍ਰੀਵੀਅਸ ਪੇਪਰ ਦੀ ਬੁੱਕ ਮਿਲ ਜਾਵੇਗੀ ਪੰਜਾਬੀ ਦੀ ਓਕੇ ਮੈਮ ਔਰ ਇਹਨਾਂ ਦੇ ਰੇਟ ਕੀ ਕੀ ਨੇ ਮੈਮ ਹਾਂਜੀ ਓਕੇ ਮੈਮ ਅਤੇ ਮੈਮ ਇਹ 'ਤੇ ਸਾਨੂੰ ਕੋਈ ਛੂਟ ਵਗੈਰਾ ਵੀ ਮਿਲੇਗੀ ਹਾਂ ਮੈਮ ਮੈਂ ਨਾ ਤੁਹਾਨੂੰ ਆਪਣਾ ਐਡਰੈੱਸ ਭੇਜਦਾਂਗੀ ਮੈਮ ਮੇਰਾ ਐਡਰੈੱਸ ਹੈ ਪਿੰਡ ਚੰਗੀ ਰਾਣਾ ਜ਼ਿਲ੍ਹਾ ਅਤੇ ਤਹਿਸੀਲ ਬਠਿੰਡਾ ਪਿੰਨ ਕੋਡ ਪੰਦਰਾਂ ਚੌਦਾਂ ਜ਼ੀਰੋ ਇੱਕ ਮਕਾਨ ਨੰਬਰ ਚਾਰ ਸੌ ਅਠੱਤੀ ਨੇੜੇ ਗੁਰਦੁਆਰਾ ਸਾਹਿਬ ਤਾਂ ਮੈਮ ਕਿੰਨੇ ਕੁ ਦਿਨਾਂ ਤੱਕ ਤੁਸੀਂ ਸਾਨੂੰ ਜਿਹੜੀਆਂ ਬੁੱਕਸ ਆ ਮਤਲਬ ਪਹੁੰਚਾ ਸਕਦੇ ਹੋ ਓਕੇ ਮੈਮ ਔਰ ਮੈਮ ਕੋਈ ਇਸ ਤੋਂ ਇਲਾਵਾ ਬੁੱਕ ਅਗਰ ਹੋਵੇ ਤਾਂ ਮੈਮ ਅ ਰਿਹਾਨ ਦੀ ਬੁੱਕ ਮਿਲ ਜਾਵੇਗੀ ਇੱਕ ਓਕੇ ਮੈਮ ਅਤੇ ਮੈਮ ਤੁਸੀਂ ਸਾਨੂੰ ਸਾਡੇ ਨਾ ਇਸ ਐਡਰੈੱਸ 'ਤੇ ਜਿਹੜੀਆਂ ਤੁਸੀਂ ਬੁੱਕਸ ਸਾਨੂੰ ਭੇਜ ਦਿਓ ਅਤੇ ਮੈਮ ਪੇਮੈਂਟ ਔਨਲਾਈਨ ਦਾ ਹੈ ਨਾ ਓਕੇ ਮੈਮ ਠੀਕ ਹੈ ਫਿਰ ਮੈਮ ਮੈਂ ਤੁਹਾਨੂੰ ਇਸ ਨੰਬਰ 'ਤੇ ਨਾ ਆਪਣਾ ਐਡਰੈੱਸ ਵਗੈਰਾ ਸਭ ਮਤਲਬ ਜੋ ਹੈ ਭੇਜਦਾਂਗੀ ਤੁਸੀਂ ਸਾਨੂੰ ਬੁੱਕਸ ਜਿਹੜੀਆਂ ਉਹ ਭੇਜ ਦੇਣਾ ਓਕੇ ਮੈਮ ਥੈਂਕ ਯੂ